ਪੰਜਾਬ ਵਿੱਚ ਸਾਨੂੰ ਕਲਾ ਦੇ ਵੱਖ ਵੱਖ ਰੂਪ ਦੇਖਣ ਨੂੰ ਮਿਲਦੇ ਆ ਜਿਵੇਂ ਅਸੀਂ ਪੰਜਾਬ ਦੇ ਜੇਕਰ ਪਿੰਡਾਂ ਵਿੱਚ ਚਲੇ ਜਾਈਏ ਤਾਂ ਉੱਥੋਂ ਦੇ ਪੁਰਾਣੇ ਘਰ ਜੋ ਕਿ ਮਿੱਟੀ ਦੇ ਬਣੇ ਹੋਏ ਸਨ ਤੇ ਉੱਥੇ ਔਰਤਾਂ ਆਪਣੇ ਘਰਾਂ ਨੂੰ ਲਿੰਬ ਦੀਆਂ ਪੋਚਦੀਆਂ ਤੇ ਕਲਾ ਦੇ ਬੜੇ ਸੋਹਣੇ ਨਮੂਨੇ ਉਥੇ ਉਤਰਾਈਆਂ ਜਾਂਦੇ ਹਨ ਇਸੇ ਹੀ ਤਰ੍ਹਾਂ ਕਲਾ ਰੂਪ ਅਤੇ ਚਿੱਤਰਕਾਰੀ ਨੂੰ ਪ੍ਰਫੁੱਲਿਤ ਕਰਨ ਦੀ ਪੰਜਾਬ ਸਰਕਾਰ ਨੇ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਕਈ ਤਰ੍ਹਾਂ ਦੇ ਵੱਖ ਵੱਖ ਸਕੂਲ ਖੋਲ੍ਹੇ ਜਾ ਰਹੇ ਆ ਅਤੇ ਕਈ ਨਿੱਜੀ ਸੰਸਥਾ ਦੀ ਹਨ ਜਿਵੇਂ ਕਿ ਚੰਡੀਗੜ੍ਹ ਵਿੱਚ ਗੌਰਮੈਂਟ ਕਾਲਜ ਆਫ ਆਰਟ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਕਲਾ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਆ ਪੰਜਾਬ ਦੇ ਪੰਜਾਬ ਵਿੱਚ ਕਲਾ ਭਵਨ ਅਤੇ ਪੰਜਾਬੀ ਯੂਨੀਵਰਸਿਟੀ ਆਫ ਪਟਿਆਲਾ ਹੈ ਜੋ ਕਿ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਆਪਣਾ ਯੋਗਦਾਨ ਦੇ ਰਹੇ ਹਨ